ਹੈਲੋ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਕਿੰਨੇ ਮੈਂਬਰ ਹੋ ਤੁਸੀਂ

ਅੱਛਾ ਜੀ ਅਤੇ ਸੀਨੀਅਰ ਅਡਲਟ ਕਿੰਨੇ ਅੱਛਾ ਜੂਨੀਅਰ ਅਤੇ ਅਡਲਟ ਕਿੰਨੇ ਨੇ ਜੀ ਅੱਛਾ ਠੀਕ ਆ ਠੀਕ ਆ ਠੀਕ ਆ ਤੁਸੀਂ ਕਿੱਥੇ ਦਾ ਸੋਚ ਰਹੇ ਹੋ ਫੇਰ ਤੁਸੀਂ ਪਲੈਨ ਕਿੱਥੇ ਦਾ ਕੀਤਾ ਹਿਮਾਚਲ ਦਾ ਹਿਮਾਚਲ ਦਾ ਤੁਸੀਂ ਦੇਖੋ ਸਭ ਤੋਂ ਜਿਹੜਾ ਨੇੜੇ ਪਵੇ ਸ਼ਿਮਲਾ ਸ਼ਿਮਲਾ ਵੀ ਖਾਸ ਹੈ ਨਹੀਂ ਘੁੰਮਣ ਨੂੰ ਉਸ ਤੋਂ ਬਾਅਦ ਤੁਸੀਂ ਜਾ ਸਕਦੇ ਮਨਾਲੀ ਨੂੰ ਮਨਾਲੀ ਤੋਂ ਬਾਅਦ ਜੇ ਉਹ ਤੋਂ ਵੀ ਅੱਗੇ ਜਾਣਾ ਤੁਸੀਂ ਤਾਂ ਉਹਦੇ ਵਾਸਤੇ ਤੁਸੀਂ ਲੇਹ ਲਦਾਖ ਦਾ ਦੇਖ ਸਕਦੇ ਹੋ ਉਹ ਕੁਝ ਕਾ ਜ਼ਿਆਦਾ ਹੀ ਵਧੀਆ ਆ ਜਾਂਦਾ ਅਤੇ ਉਹਦਾ ਪੈਕੇਜ ਵੀ ਥੋੜ੍ਹਾ ਮਹਿੰਗਾ ਪੈ ਜਾਂਦਾ ਕਿੰਨਾ ਇੱਕ ਪਰ ਪਰਸਨ ਦਸ ਹਜ਼ਾਰ ਜੀ ਦੇਖੋ ਜਿਹੜਾ ਲੇਹ ਲਦਾਖ ਵਾਲਾ ਟ੍ਰਿਪ ਹੋਵੇਗਾ ਜੀ ਉਹ ਤੁਹਾਨੂੰ ਪੈ ਜਾਵੇਗਾ ਪੂਰੇ ਦਾ ਪੂਰਾ ਟ੍ਰਿਪ ਤੁਹਾਨੂੰ ਤੀਹ ਹਜ਼ਾਰ ਦਾ ਪੈ ਜਾਊ ਵਿੱਚ ਸਾਰਾ ਕੁਝ ਇਨਕਲੂਡ ਖਾਣ ਪੀਣ ਸਾਰਾ ਹੋਟਲ ਦਾ ਰਹਿਣ ਸਾਰੇ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਅਤੇ ਜਿਹੜਾ ਮਨਾਲੀ ਵਾਲਾ ਟ੍ਰਿਪ ਹੋਵੇਗਾ ਜੀ ਉਹ ਤੁਹਾਨੂੰ ਆਰਾਮ ਨਾਲ ਬਾਰ੍ਹਾਂ ਕੁ ਹਜ਼ਾਰ ਦਾ ਪੈ ਜੂਗਾ ਸਾਰੇ ਦੇ ਸਾਰੇ ਮੈਂਬਰਾਂ ਦਾ ਮਿਲਾ ਕੇ ਖਾਣ ਪੀਣ ਵਿੱਚ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਸ਼ਿਮਲੇ ਵਾਲਾ ਟੂਰ ਆ ਇਹਦਾ ਠੀਕ ਹੈ ਤਾਂ ਤੁਹਾਨੂੰ ਆਰਾਮ ਨਾਲ ਪੱਚੀ ਸੌ ਤਿੰਨ ਹਜ਼ਾਰ ਦਾ ਪਵੇਗਾ ਸਾਡੇ ਹੋਟਲਾਂ ਹੁਟਲਾਂ ਵਾਲਿਆਂ ਨਾਲ ਗੱਲਬਾਤ ਹੈ ਜੀ ਉਹ ਆਪਣੇ ਆਪ ਕਰਵਾ ਦੇਣਗੇ ਤੁਹਾਡਾ ਅਤੇ ਉਸ ਤੋਂ ਬਾਅਦ ਦੇਖਣਾ ਹੋਵੇ ਮੰਸੂਰੀ ਵੀ ਜਾ ਸਕਦੇ ਹੋ ਅਤੇ ਮੰਸੂਰੀ ਤੋਂ ਬਾਅਦ ਤੁਹਾਨੂੰ ਉੱਧਰ ਵੀ ਉਹ ਲੈ ਕੇ ਜਾ ਸਕਦੇ ਅਸੀਂ ਈਸਟ ਵੱਲ ਉੱਥੇ ਸਾਰਾ ਉਹ ਆ ਮੰਸੂਰੀ ਦਾ ਤਾਂ ਦੇਖੋ ਤੁਹਾਨੂੰ ਆਰਾਮ ਮੰਸੂਰੀ ਦਾ ਵੀ ਠੀਕ ਪੰਦਰ੍ਹਾਂ ਕੁ ਹਜ਼ਾਰ ਮੰਸੂਰੀ ਦਾ ਪੈਣਾ ਸਾਰਾ ਘੁੰਮਾਉਣ ਫਰੋਨ ਰਹਿਣ ਸਹਿਣ ਸਭ ਕੁਝ ਉਹਦੇ ਵਿੱਚ ਹਾਂਜੀ ਹਾਂਜੀ ਆਪਣੇ ਇੱਥੋਂ ਪਟਿਆਲੇ ਤੋਂ ਅਤੇ ਜੇ ਤੁਸੀਂ ਕਹੋ ਤੁਹਾਨੂੰ ਉੱਧਰਲੇ ਪਾਸੇ ਲੈ ਕੇ ਜਾਈਏ ਅਸੀਂ ਦਾਰਜਲਿੰਗ ਵਾਲੀ ਸਾਈਡ ਤਾਂ ਉਹ ਥੋੜ੍ਹਾ ਮਹਿੰਗਾ ਪੈ ਜਾਂਦਾ ਉਹ ਤੁਹਾਨੂੰ ਪਰ ਪਰਸਨ ਦਸ ਹਜ਼ਾਰ ਪੈ ਜਾਵੇਗਾ ਮਤਲਬ ਤੁਹਾਨੂੰ ਐਂ ਲਾ ਲਓ ਤੁਸੀਂ ਉਹ ਤੁਹਾਡਾ ਕਰੀਏ ਅਸੀਂ ਤੀਹ ਕੁ ਹਜ਼ਾਰ 'ਚ ਟ੍ਰਿਪ ਕਢਾ ਦਿਆਂਗੇ ਸਾਰਿਆਂ ਦਾ ਹਾਂਜੀ ਹਾਂਜੀ ਉਸ ਤੋਂ ਬਾਅਦ ਜੇ ਤੁਸੀਂ ਦੇਖਣਾ ਸਮੁੰਦਰ ਵਾਲੇ ਪਾਸੇ ਜਾਣਾ ਤੁਸੀਂ ਗੋਆ ਵੀ ਜਾ ਸਕਦੇ ਹੋ ਗੋਆ ਵੀ ਕਾਫੀ ਵਧੀਆ ਟਰਿਪ ਰਹਿੰਦਾ ਜੀ ਪਰ ਗੋਆ ਥੋੜ੍ਹਾ ਜਿਹਾ ਮਹਿੰਗਾ ਚਲਾ ਜਾਂਦਾ ਗੋਆ ਤੁਹਾਨੂੰ ਪੰਤਾਲੀ ਹਜ਼ਾਰ ਦਾ ਪੈ ਜਾਣਾ ਛੇ ਜਾਣਿਆਂ ਦਾ ਹਾਂਜੀ ਉਹ ਗੋਆ ਦੀ ਵੀ ਟਰਿਪ ਬਹੁਤ ਵਧੀਆ ਜੇ ਤੁਸੀਂ ਕਹੋ ਤੁਹਾਨੂੰ ਅੱਗੇ ਤਾਂ ਬਾਹਰ ਫੋਰਨ ਵੀ ਲੈ ਕੇ ਜਾ ਸਕਦੇ ਹਾਂ ਜੇ ਤੁਸੀਂ ਤੀਰਥ ਵਗੈਰਾ ਘੁੰਮਣਾ ਤੁਹਾਨੂੰ ਉੜੀਸਾ ਵਗੈਰਾ ਵੀ ਉੱਧਰਲੀ ਸਾਈਡ 'ਤੇ ਵੀ ਮੰਦਰਾਂ 'ਚ ਲੈ ਕੇ ਜਾ ਸਕਦੇ ਹਾਂ ਅਸੀਂ ਉੱਧਰ ਕਹੋ ਉੱਧਰ ਜਾ ਸਕਦੇ ਹਾਂਜੀ ਹਾਂਜੀ ਉਹ ਘੁੰਮਣ ਨੂੰ ਉੜੀਸਾ ਵੀ ਬਹੁਤ ਕੁਝ ਆ ਬੜੀ ਵਧੀਆ ਜਗ੍ਹਾ ਉੜੀਸਾ ਘੁੰਮਣ ਨੂੰ ਵੀ ਜੇ ਤੁਸੀਂ ਕਹੋ ਬਾਹਰਲਾ ਪਾਸੇ ਗੇੜਾ ਲਾਉਣਾ ਤੁਸੀਂ ਦੁਬਈ ਵਾਲੀ ਸਾਈਡ ਤਾਂ ਉੱਧਰਲੇ ਪਾਸੇ ਵੀ ਗੇੜਾ ਲਵਾ ਦੇਣਾ ਉਹ ਤੁਹਾਡਾ ਪੂਰਾ ਲੱਖ ਦਾ ਟਰਿਪ ਪੈ ਜੂਗਾ ਤੁਹਾਡਾ ਪੂਰੇ ਦੇ ਪੂਰੇ ਪਰਿਵਾਰ ਦਾ ਹਾਂਜੀ ਹਾਂਜੀ ਹਾਂਜੀ ਬਾਕੀ ਤੁਸੀਂ ਦੇਖ ਲਓ ਆ ਕੇ ਸਾਡੇ ਮਿਲ ਲਿਓ ਜ਼ਰੂਰ ਇੱਥੇ ਦੁਕਾਨ 'ਤੇ ਆ ਜਿਓ ਤੁਹਾਨੂੰ ਆਪਾਂ ਦੱਸ ਲਾਂਗੇ ਬਹਿ ਕੇ ਪਲੈਨ ਕਰ ਲਾਂਗੇ ਜਿੰਨੀ ਡਿਸਕਾਊਂਟ ਵਗੈਰਾ ਮਿਲਦਾ ਹੋਇਆ ਦੇਖ ਲਾਂਗੇ ਉਹੀ ਆਪਾਂ ਐਡਰੈਸ ਤੁਸੀਂ ਆ ਜਿਓ ਜੀ ਇਹ ਹੈਗਾ ਆਪਣਾ ਫੇਸ ਟੂ ਅਤੇ ਜੀ ਐਸ ਟਰੈਵਲ ਪਟਿਆਲਾ ਹਾਂਜੀ ਹਾਂਜੀ ਹਾਂਜੀ ਚਲੋ ਆ ਕੇ ਭਾਅ ਜੀ ਜ਼ਰੂਰ ਮਿਲਿਓ ਦੱਸਿਓ ਕੀ ਬਣਦਾ ਤੁਹਾਡਾ ਓਕੇ